ਬਾਈ ਸਤੰਬਰ ਦੋ ਹਜ਼ਾਰ ਪੰਜ ਪੰਦਰ੍ਹਾਂ ਅਗਸਤ ਉੱਨੀ ਸੌ ਸਤਾਨਵੇਂ ਛੱਬੀ ਅਪ੍ਰੈਲ ਦੋ ਹਜ਼ਾਰ ਦਸ ਪੰਜ ਅਕਤੂਬਰ ਦ ਉੱਨੀ ਸੌ ਅੱਸੀ ਦਸ ਮਈ ਦੋ ਹਜ਼ਾਰ ਸਤਾਰ੍ਹਾਂ